ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਪੰਜਾਬ ਵਿੱਚ ਰਹਿੰਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਬਹੁਤ ਹੀ ਲਗਾਅ ਹੈ ਈਵਨ ਕਿ ਮੈਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਹੀ ਲਗਾਅ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਇੱਕ ਪੰਜਾਬੀ ਹਾਂ ਵਪਾਰ ਅਤੇ ਵਣਜ ਵਿੱਚ ਵੀ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਹੈ ਪੰਜਾਬੀ ਜੇਕਰ ਅਸੀਂ ਵਪਾਰ ਦੀ ਗੱਲ ਕਰਦੇ ਹਾਂ ਤਾਂ ਇਹ ਜ਼ਰੂਰੀ ਨਹੀਂ ਕਿ ਸਾਨੂੰ ਹਰ ਭਾਸ਼ਾ ਦਾ ਗਿਆਨ ਹੋਵੇ ਭਾਸ਼ਾ ਤਾਂ ਬਸ ਇੱਕ ਜ਼ਰੀਆ ਹੈ ਜਿਹਦੇ ਨਾਲ ਅਸੀਂ ਆਪਣੇ ਵਿਚਾਰ ਇੱਕ ਦੂਜੇ ਤੱਕ ਪਹੁੰਚਾ ਸਕਦੇ ਹਾਂ ਵਪਾਰ ਵਿੱਚ ਜ਼ਰੂਰੀ ਨਹੀਂ ਹੈ ਕਿ ਸਾਨੂੰ ਹਰ ਭਾਸ਼ਾ ਆਉਂਦੀ ਹੋਵੇ ਵਪਾਰ ਵਿੱਚ ਜੇ ਕੋਈ ਚੀਜ਼ ਮੈਟਰ ਕਰਦੀ ਹੈ ਤਾਂ ਉਹ ਬਸ ਹੈ ਸਾਡੀ ਬੁੱਧੀ ਸਾਡੀ ਸੋਚ ਸਾਡੀ ਸਮਝ ਜਿਹਦੇ ਨਾਲ ਅਸੀਂ ਸਮਝ ਸਕਦੇ ਹਾਂ ਕਿ ਵਪਾਰ ਕਰਨਾ ਕਿਵੇਂ ਹੈ ਭਾਸ਼ਾ ਤਾਂ ਬਸ ਇੱਕ ਜ਼ਰੀਆ ਹੈ ਸਾਡੇ ਪੰਜਾਬ ਦੇ ਕਈ ਮਸ਼ਹੂਰ ਗਾਇਕ ਹਨ ਜਿਹੜੇ ਪੰਜਾਬੀ ਬੋਲੀ ਨੂੰ ਇੰਟਰਨੈਸ਼ਨਲ ਲੈਵਲ ਤੱਕ ਵੀ ਲੈ ਕੇ ਗਏ ਹਨ ਜਿਵੇਂ ਕਿ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਨੇ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਬਹੁਤ ਹੀ ਇੰਮਪ੍ਰੈਸ ਕੀਤਾ ਹੈ ਈਵਨ ਕਿ ਇਹ ਵਿਦੇਸ਼ਾਂ ਵਿੱਚ ਵੀ ਗਾਣੇ ਉਸਦੇ ਸੁਣੇ ਜਾਂਦੇ ਹਨ ਲੋਕਾਂ ਨੂੰ ਇਸਦੇ ਗਾਣੇ ਸੁਣਨਾ ਬਹੁਤ ਹੀ ਪਸੰਦ ਹੈ ਵਿਦੇਸ਼ ਵਿੱਚ ਰਹਿੰਦੇ ਲੋਕਾਂ ਨੂੰ ਪੰਜਾਬੀ ਬੋਲੀ ਨਾਲ ਬਹੁਤ ਹੀ ਜ਼ਿਆਦਾ ਲਗਾਅ ਹੋ ਗਿਆ ਹੈ ਵਿਦੇਸ਼ਾਂ ਵਿੱਚ ਰਹਿੰਦੇ ਲੋਕੀਂ ਪੰਜਾਬੀ ਬੋਲੀ ਸਿੱਖਣਾ ਚਾਹੁੰਦੇ ਹਨ ਉਸ ਨੂੰ ਸਮਝਣਾ ਚਾਹੁੰਦੇ ਹਨ ਕਈ ਲੋਕੀਂ ਤਾਂ ਪੰਜਾਬ ਵਿੱਚ ਰਹਿ ਕੇ ਉਸਦੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਹਨ ਇਸ ਪ੍ਰਕਾਰ ਭਾਸ਼ਾਵਾਂ ਦੀ ਵਰਤੋਂ ਵਪਾਰ ਅਤੇ ਵਣਜ ਵਿੱਚ ਕੀਤੀ ਜਾਂਦੀ ਹੈ